ਮੈਨੂੰ ਡਰਾਇੰਗ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਸਕੂਲ ਟਾਈਮ ਤੋਂ ਹੀ ਫਸਟ ਕਲਾਸ ਤੋਂ ਹੀ ਸਾਨੂੰ ਡਰਾਇੰਗ ਦਾ ਸਬਜੈਕਟ ਲੱਗ ਗਿਆ ਸੀਗਾ ਅਤੇ ਮੈਂ ਉਦੋਂ ਤੋਂ ਹੀ ਡਰਾਇੰਗ ਕਰਨਾ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਅਤੇ ਮੈਨੂੰ ਉਦੋਂ ਤੋਂ ਹੀ ਡਰਾਇੰਗ ਕਰਨ ਦਾ ਸ਼ੌਂਕ ਪੈ ਗਿਆ ਅਤੇ ਕਈ ਵਾਰ ਮੈਂ ਫਸਟ ਜਾਂ ਫਿਫ਼ਥ ਕਲਾਸ ਵਿੱਚ ਡਰਾਇੰਗ ਕੰਪਟੀਸ਼ਨ ਵਿੱਚ ਪਾਰਟੀਸਪੇਟ ਕੀਤਾ ਅਤੇ ਉਦੋਂ ਤੋਂ ਕਈ ਵਾਰ ਮੇਰੀ ਪੁਜੀਸ਼ਨ ਫਸਟ ਜਾਂ ਸੈਕੰਡ ਵੀ ਆਈ ਅਤੇ ਉਸ ਕੰਪਟੀਸ਼ਨ ਵਿੱਚ ਪਾਰਟੀਸਪੇਟ ਕਰਨ ਤੋਂ ਬਾਅਦ ਮੈਂ ਕਈ ਵਾਰ ਹਾਰ ਵੀ ਮੈਨੂੰ ਹਾਰ ਵੀ ਮਿਲੀ ਪਰ ਮੈਂ ਉਹ ਹਾਰ ਨਹੀਂ ਮੰਨੀ ਮੈਂ ਹੋਰ ਜ਼ਿਆਦਾ ਪ੍ਰੈਕਟਿਸ ਕੀਤੀ ਆਪਣੇ ਡਰਾਇੰਗ ਨੂੰ ਹੋਰ ਜ਼ਿਆਦਾ ਸੁਧਾਰਨ ਦੀ ਕੋਸ਼ਿਸ਼ ਕੀਤੀ ਅਤੇ ਅ ਮੈਂ ਆਪਣੀ ਡਰਾਇੰਗ ਸੁਧਾਰਨ ਲਈ ਨੈਟ ਦੀ ਜਾਂ ਯੂਟੀਊਬ ਦੀ ਮਦਦ ਲਈ ਸੀ ਉੱਥੋਂ ਮੈਂ ਬਹੁਤ ਸਾਰੀਆਂ ਵੀਡੀਓਜ਼ ਵਗੈਰਾ ਵੇਖੀਆਂ ਅਤੇ ਆਪਣੇ ਡਰਾਇੰਗ ਦੀ ਪ੍ਰੈਕਟਿਸ ਕੀਤੀ ਮੈਂ ਹਰ ਰੋਜ਼ ਜਦੋਂ ਵੀ ਫਰੀ ਹੁੰਦੀ ਹਾਂ ਜਾਂ ਕਿਸੇ ਫਰੀ ਟਾਈਮ ਮੈਂ ਬੋਰ ਹੋ ਰਹੀ ਹਾਂ ਤਾਂ ਉੱਦੋਂ ਮੈਂ ਡਰਾਇੰਗ ਕਰਦੀ ਹਾਂ ਹ ਮੇਰੀ ਡਰਾਇੰਗ ਜਾਂ ਮੈਂ ਜਿੰਨੀਆਂ ਵੀ ਡਰਾਇੰਗਜ਼ ਕਰਦੀ ਹਾਂ ਮੇਰੇ ਟੀਚਰ ਫਰੈਂਡਸ ਸਭ ਨੂੰ ਮੇਰੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਹਨ ਅਤੇ ਅਤੇ ਮੈਂ ਹੋਰ ਵੀ ਬਹੁਤ ਜ਼ਿਆਦਾ ਅਤੇ ਮੈਂ ਹੋਰ ਅਤੇ ਮੈਂ ਹੋਰ ਵੀ ਡਰਾਇੰਗ ਕੰਪਟੀਸ਼ਨ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੀ ਹਾਂ